ਪੰਜਾਬ ਰਾਜ ਵਿੱਚ ਪੰਜਾਬੀ ਜਿਹੜੀ ਆ ਉਹ ਬੋਲੀ ਜਾਂਦੀ ਹੈ ਪਰ ਪੰਜਾਬੀ ਦੇ ਵਿੱਚ ਵੀ ਕਈ ਹੋਰ ਉਪਬੋਲੀਆਂ ਹਨ ਜਿਵੇਂ ਕਿ ਪੋਟੋਹਾ ਪੋਠੋਹਾਰੀ ਦੁਆਬੀ ਮਾਝੀ ਮਾਲਵੀ ਇਹਨਾਂ ਦਾ ਬੋਲਚਾਲ ਦਾ ਜਿਹੜਾ ਉਹ ਤਰੀਕਾ ਹਰੇਕ ਦਾ ਥੋੜ੍ਹਾ ਥੋੜ੍ਹਾ ਵੱਖਰਾ ਹੈ ਇਸ ਤਰ੍ਹਾਂ ਅਲੱਗ ਅਲੱਗ ਸੱਭਿਆਚਾਰਾਂ ਨੂੰ ਵਿਖਾਉਂਦੀਆਂ ਹਨ ਜਿਵੇਂ ਕਿ ਮਾਝੇ ਵਾਲੇ ਜਿਹੜੇ ਆ ਉਹ ਜ਼ਿਆਦਾਤਰ ਮਹਾਰਾਜ ਕਹਿ ਕੇ ਆਵਾਜ਼ ਦਿੰਦੇ ਹਨ ਜਾਂ ਮਾਲਵਾ ਵਾਲਾ ਜਿਹੜਾ ਉਹ ਬਾਈ ਜੀ ਕਹਿ ਕੇ ਕਿਸੇ ਨੂੰ ਸੰਬੋਧਨ ਕਰਦੇ ਹਨ ਅਸੀਂ ਮਾਝੇ ਵਾਲੇ ਜਿਹੜੇ ਉਹ ਭਾਅ ਜੀ ਕਹਿੰਦੇ ਆ ਅਤੇ ਅਤੇ ਜਿਹੜਾ ਦੁਆਬਾ ਉਹ ਵੋਵੇ ਨੂੰ ਬੱਬਾ ਕਹਿ ਕੇ ਬੋਲਦੇ ਨੇ ਜ਼ਿਆਦਾਤਰ ਜਿਵੇਂ ਵੱਡੀਆਂ ਹੋਗੀਆਂ ਨੂੰ ਕਹਿਣਾ ਹੋਵੇ ਅਤੇ ਉਹ ਕਹਿੰਦੇ ਬੱਡੀਆਂ ਹੋ ਗਈਆਂ